ਹੈਲੋ ਹਾਂਜੀ ਭਾਅ ਜੀ ਕੀ ਹਾਲ ਚਾਲ ਐ ਭਾਅ ਜੀ ਮੈਂ ਕਿਹਾ ਭਾਅ ਜੀ ਗੁਪਤਾ ਟ੍ਰਾਂਸਪੋਟ ਤੋਂ ਬੋਲਦੇ ਪਏ ਭਾਅ ਜੀ ਮੈਂ ਕਿਹਾ ਭਾਅ ਜੀ ਮੈਂ ਤੁਹਾਡੀ ਕੈਬ ਬੁੱਕ ਕਰਾਈ ਸੀ ਦਸ ਵਜੇ ਭਾਅ ਜੀ ਮੈਂ ਬੈਂਕ ਜਾਣਾ ਪੀ ਐੱਨ ਬੀ ਬੈਂਕ ਭਾਅ ਜੀ ਮੈਨੂੰ ਸਾਢੇ ਨੌਂ ਵਜੇ ਗਏ ਮੈਂ ਅੱਧਾ ਘੰਟਾ ਹੋ ਗਿਆ ਮੈਨੂੰ ਖੜੇ ਨੂੰ ਭਾਅ ਜੀ ਮੈਂ ਪਿੱਕ ਅੱਪ ਪੁਆਇੰਟ ਤੇ ਖੜਾ ਭਾਅ ਜੀ ਮਾਲ ਰੋੜ 'ਤੇ ਖੜਾ ਮੈਂ ਕਿਹਾ ਭਾਅ ਜੀ ਕਿੰਨਾ ਕੁ ਟੈਮ ਹੋਰ ਲੱਗਣਾ ਭਾਅ ਜੀ ਮੈਂ ਕਿਹਾ ਭਾਅ ਜੀ ਉਹ ਜਿਨ੍ਹਾਂ ਨੇ ਕੈਬ ਲੈ ਕੇ ਆਉਣੀ ਆ ਉਨ੍ਹਾਂ ਨੂੰ ਕਹੋ ਜਲਦੀ ਤੋਂ ਜਲਦੀ ਆ ਜਾਣ ਭਾਅ ਜੀ ਮੇਰਾ ਪੀ ਐੱਨ ਬੀ ਬੈਂਕ ਬਹੁਤ ਜਰੂਰੀ ਕੰਮ ਐ ਭਾਅ ਜੀ ਭਾਅ ਜੀ ਭੇਜ ਦੋ ਜਲਦੀ ਜਲਦੀ ਭੇਜ ਦੋ ਭਾਅ ਜੀ ਮੈਂ ਚੱਕਰ ਪਤਾ ਕੀ ਐ ਭਾਅ ਜੀ ਮੈਂ ਫੋਮ ਵੀ ਫੋਮ ਭਰਨਾ ਵਾ ਮੈਂ ਨੌਕਰੀ ਲੱਗਣੀ ਮੇਰੀ ਜੇ ਮੈਥੋਂ ਫੋਮ ਨਾ ਭਰਿਆ ਗਿਆ ਤਾਂ ਫੇਰ ਮੈਨੂੰ ਅਗਲੇ ਨੈਕਸਟ ਈਅਰ 'ਚ ਔਖਾ ਹੋ ਜਾਣਾ ਮੈਂ ਕਿਹਾ ਭਾਅ ਜੀ ਮੈਂ ਕੱਲ ਵੀ ਕਿਤੇ ਜਾਣਾ ਵਾ ਮੈਂ ਤੁਹਾਡੀ ਕੈਬ ਬੁੱਕ ਕਰਾਊਂਗਾ ਭਾਅ ਜੀ ਤੇ ਏਸ ਕਰਕੇ ਪਲੀਸ ਤੁਸੀਂ ਉਨ੍ਹਾਂ ਨੂੰ ਜਲਦੀ ਜਲਦੀ ਕਹਿ ਦੋ ਵੀ ਜਲਦੀ ਜਲਦੀ ਜਿੱਥੇ ਵੀ ਹੈਗੇ ਐ ਆਜੋ ਮੈਂ ਪਿੱਕ ਅੱਪ ਪੁਆਇੰਟ ਤੇ ਖੜਾ ਭਾਅਜੀ ਮਾਲ ਰੋੜ ਤੇ ਭਾਅ ਜੀ ਭੇਜ ਦੋ ਭਾਅ ਜੀ ਜਿਆਦਾ ਬਹੁਤ ਬਹੁਤ ਧੰਨਵਾਦ ਆ ਭਾਜੀ ਤੇ ਨਾਲੇ ਭਾਅ ਜੀ ਤਾਡੀ ਪੀ ਤਾਡੀ ਮੈਨੂੰ ਤਾਡੀ ਕੈਬ ਦਾ ਵੀ ਬਹੁਤ ਸੋਹਣਾ ਮਿਲਿਆ ਤਾਡੀ ਤਾਹੀਂ ਮੈਂ ਕੈਬ ਬੁੱਕ ਕਰਾਈ ਐ ਭਾਅ ਜੀ ਜੇ ਤੁਸੀਂ ਵਧੀਆ ਭੇਜ ਕਰੂੰਗੇ ਤੇ ਭਾਜੀ ਗਾਹ ਤਾਡੀ ਰੇਟਿੰਗ ਹੋਰ ਵਧੂਗੀ ਮਾਰਕਿੰਗ ਤਾਡੀ ਵਧੂਗੀ ਪਲੀਸ ਭਾਅ ਜੀ ਉਨ੍ਹਾਂ ਨੂੰ ਕਹੋ ਜਿੱਥੇ ਵੀ ਹੈਗੇ ਤੁਸੀਂ ਓਥੋਂ ਭੇਜ ਦੋ ਮੈਨੂੰ ਤੇ ਨਾਲ ਈ ਮੈਂ ਫੇਰ ਚਲਜਾਂਨਾ ਭਾਅ ਜੀ